ਮੇਰਾ ਵਾਸਤਾ ਰੂਰਲ ਅਤੇ ਅਰਬਨ ਦੋਨਾਂ ਦੇ ਨਾਲ ਡੇਲੀ ਪੈਂਦਾ ਹੈ ਰੂਰਲ ਏਰੀਏ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਆਪਣਾ ਕੁਟੀਆ ਬਣਾਈ ਹੋਈ ਹੈ ਜਿੱਥੇ ਮੈਂ ਰਹਿੰਦਾ ਹਾਂ ਅਤੇ ਮੈਂ ਜੋ ਕੰਮ ਕਰਦਾ ਹਾਂ ਸਕੂਲ ਜੋ ਹੈ ਉਹ ਅਰਬਨ ਏਰੀਏ ਵਿੱਚ ਹੈ ਪਿੰਡਾ ਦੇ ਵਿੱਚ ਕੱਟ ਜ਼ਿਆਦਾ ਲਗਦੇ ਹਨ ਅਤੇ ਸ਼ਹਿਰਾਂ ਵਿੱਚ ਘੱਟ ਘੱਟ ਲਗਦੇ ਹਨ ਅਤੇ ਕੱਟਾਂ ਦੇ ਤਾਂ ਅੱਜਕਲ ਵੈਸੇ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਸਾਧਨ ਇੰਨੇ ਹੋ ਗਏ ਘਰਾਂ 'ਚ ਇਨਵੇਟਰ ਲੱਗੇ ਹੋਏ ਹੈ ਜੇ ਸਕੂਲ ਵੱਡੇ ਹੈ ਉਹਨਾਂ 'ਚ ਜਨਰੇਟਰ ਲੱਗੇ ਹੋਏ ਹੈ ਇਸ ਕਰਕੇ ਇਹ ਸਹੂਲਤਾਂ ਜਿਹੜੀਆਂ ਨਵੀਆਂ ਮੋਡਰਨ ਮਿਲ ਰਹੀਆਂ ਕੱਟਾਂ ਦਾ ਕੋਈ ਖ਼ਾਸ ਮਹੱਤਵ ਨਜ਼ਰ ਨਹੀਂ ਆਂਦਾ ਲੇਕਿਨ ਸਰਕਾਰ ਨੂੰ ਕੱਟ ਲਗਾ ਕੇ ਜ਼ਰੂਰ ਫਾਇਦਾ ਹੁੰਦਾ ਉਹਨਾਂ ਨੇ ਕੀ ਕੀਤਾ ਇਸ ਵਾਰ ਤਾਂ ਪੰਜਾਬ ਦੇ ਵਿੱਚ ਕਮਾਲ ਕਰਕੇ ਰੱਖ ਦਿੱਤੀ ਬਿਜਲੀ ਦੇ ਜ਼ਿਆਦਾ ਖਪਤਕਾਰ ਏ ਸੀ ਹੁੰਦੇ ਹਨ ਏਸੀਆਂ ਨੂੰ ਘੱਟ ਚਲਾਊਗੇ ਤਾਂ ਬਿਜਲੀ ਘੱਟ ਖਪਤ ਹੋਵੇਗੀ ਬਿਜਲੀ ਤਾਂ ਪੈਦਾ ਉਨੀਓ ਹੋ ਰਹੀ ਹੈ ਲੇਕਿਨ ਓਹਦੀ ਖਪਤ ਨੂੰ ਘੱਟ ਕਰਕੇ ਵੀ ਤਾਂ ਬਿਜਲੀ ਬਚਾਈ ਜਾਂ ਸਕਦੀ ਹੈ ਤਾਂ ਪੰਜਾਬ ਸਰਕਾਰ ਨੇ ਇੱਕ ਬਹੁਤ ਬੜੀਆ ਉਪਰਾਲਾ ਕੀਤਾ ਵੀ ਜਿੰਨੇ ਵੀ ਪੰਜਾਬ ਦੇ ਦਫ਼ਤਰ ਜਿੱਥੇ ਕਿ ਛੇ ਛੇ ਵਜੇ ਤੱਕ ਏ ਸੀ ਚੱਲਦੇ ਸੀ ਓਹਨਾਂ ਨੇ ਉਹਨਾਂ ਦਾ ਟਾਈਮ ਸਵੇਰੇ ਸਾਢੇ ਸੱਤ ਤੋਂ ਢਾਈ ਵਜੇ ਤੱਕ ਕਰਤਾ ਕਿਉਂਕਿ ਸਵੇਰੇ ਸਾਢੇ ਸੱਤ ਤੋਂ ਗਿਆਰਾਂ ਕੁ ਦਸ ਗਿਆਰਾਂ ਵਜੇ ਤੱਕ ਤਾਂ ਏ ਸੀ ਚਲਾਉਣ ਦੀ ਵੈਸੇ ਹੀ ਲੋੜ ਨਹੀਂ ਪੈਂਦੀ ਮੌਸਮ ਠੀਕ ਠੀਕ ਹੁੰਦਾ ਹੈ ਉਸ ਤੋਂ ਬਾਅਦ ਘੱਟ ਟਾਈਮ ਹੀ ਏ ਸੀ ਚੱਲੇਗਾ ਜੋ ਸ਼ਾਮ ਬਿਜਲੀ ਦੀ ਖਪਤ ਤੀ ਉਸਨੂੰ ਬਚਾਉਣ ਦਾ ਬਹੁਤ ਬੜੀਆਂ ਉਪਰਾਲਾ ਜੋ ਹੈ ਪੰਜਾਬ ਸਰਕਾਰ ਨੇ ਕੀਤਾ ਹੈ ਔਰ ਸਾਨੂੰ ਚਾਹੀਦਾ ਜਿਹੜੇ ਬਾਕੀ ਦੇ ਪ੍ਰਦੇਸ਼ ਹੈ ਨਾ ਉਹ ਵੀ ਮਾਨ ਸਾਹਿਬ ਭਗਵੰਤ ਮਾਨ ਜੀ ਦੀ ਨਕਲ ਮਾਰ ਲੈਣ ਤਾਂ ਕੀ ਦੇਸ਼ ਦਾ ਕੁਝ ਹੋਰ ਪੈਦਾ ਹੋ ਸਕੇ ਜਿਹੜੀ ਬਿਜਲੀ ਦੀ ਘਾਟ ਹੈ ਉਸਨੂੰ ਇੰਝ ਪੂਰਾ ਕੀਤਾ ਜਾ ਸਕੇ